ਪੰਜਾਬੀ ਪਿੰਡ ਅਤੇ ਪੰਛੀਆਂ ਪੰਜਾਬ ਦੇ ਪਿੰਡ ਹਮੇਸ਼ਾ ਹੀ ਕੁਦਰਤ ਦੀ ਸੁੰਦਰਤਾ ਅਤੇ ਸਕੂਨ ਦਾ ਘਰ ਰਹੇ ਹਨ ਸਵੇਰ ਸਵੇਰ ਜਦੋਂ ਹਲਕਾ ਕੁ ਹਾਸਾ ਪਿੰਡ ਦੀਆਂ ਗਲੀਆਂ ਨੂੰ ਢੱਕ ਲੈਂਦਾ ਹੈ ਤਾਂ ਇੱਕ ਵੱਖਰਾ ਹੀ ਨਜ਼ਾਰਾ ਬਣ ਜਾਦਾ ਹੈ ਖੇਤਾਂ ਵਿੱਚ ਆਉਂਦੇ ਪੰਛੀਆਂ ਦੇ ਮਿੱਠੇ ਸੁਰੀਲੇ ਬੋਲ ਹਰ ਕਿਸੇ ਦੇ ਦਿਲ ਨੂੰ ਸ਼ਾਂਤੀ ਦਿੰਦੇ ਹਨ ਇਕ ਛੋਟਾ ਜਿਹਾ ਪਿੰਡ ਜਿਸ ਦਾ ਨਾਂ ਮਥਿਆਰਪੁਰ ਹੈ ਆਪਣੇ ਹਰੇ ਭਰੇ ਖੇਤਾਂ ਅਤੇ ਸੁਹਾਵਣੀ ਹਵਾਲੇ ਬਹੁਤ ਮਸ਼ਹੂਰ ਹੈ ਇਥੇ ਵੱਡੇ ਵੱਡੇ ਪਿੱਪਲ ਅਤੇ ਬੋਹੜ ਦੇ ਰੁੱਖ ਹਨ ਜਿੱਥੇ ਸਵੇਰੇ ਸ਼ਾਮ ਕਈ ਕਿਸਮ ਦੇ ਪੰਛੀ ਆ ਕੇ ਬਹਿੰਦੇ ਹਨ ਕਬੂਤਰ ਮੈਨਾ ਤੋਤਾ ਕੋਇਲ ਕਾਗ ਇਹਨਾਂ ਪੰਛੀਆਂ ਦੀਆਂ ਮਿੱਠੀਆਂ ਮਿੱਠੀਆਂ ਬੋਲੀਆਂ ਪਿੰਡ ਦੇ ਵਾਤਾਵਰਨ ਨੂੰ ਹੋਰ ਵੀ ਮਨਮੋਹਕ ਬਣਾ ਦਿੰਦੀਆਂ ਹਨ ਕੋਇਲ ਦੀ ਕੂ ਕੂ ਤੋਤੇ ਦੀ ਚੁੰਕਾਰ ਅਤੇ ਮੈਨਾਵਾਂ ਦੀਆਂ ਮਿੱਠੀਆਂ ਗੱਲਾਂ ਇਹ ਸਭ ਕੁਝ ਇੱਕ ਸੁੰਦਰ ਰਾਗ ਵਾਂਗ ਲੱਗਦੀਆਂ ਹਨ ਇਹ ਪਿੰਡ ਸਿਰਫ ਇੱਕ ਜਗ੍ਹਾ ਨਹੀਂ ਇੱਕ ਜੀਵਨ ਸ਼ੈਲੀ ਹੈ ਇੱਥੇ ਦੇ ਪੰਛੀ ਰੁੱਖ ਮੌਸਮ ਅਤੇ ਲੋਕ ਸਭ ਕੁਝ ਮਿਲ ਕੇ ਇੱਕ ਸੁੰਦਰ ਤਸਵੀਰ ਬਣਾਉਂਦੇ ਹਨ ਜੋ ਕਿ ਹਰ ਦਿਲ ਵਿੱਚ ਵਸ ਜਾਂਦੀ ਹੈ